ਸਤਿ ਸ਼੍ਰੀ ਅਕਾਲ ਮੈਂ ਰਮਨਪ੍ਰੀਤ ਕੌਰ ਬੋਲ ਰਹੀ ਹਾਂ ਮੈਂ ਇੰਸਟਾਗ੍ਰਾਮ ਦੀ ਪੇਜ ਤੋਂ ਇੱਕ ਮੋਬਾਈਲ ਫ਼ੋਨ ਦੇਖਿਆ ਸੀ ਜੋ ਕਿ ਸੈਮਸੰਗ ਕੰਪਨੀ ਦਾ ਹੈ ਇਸ ਦਾ ਰੰਗ ਰੋਜ਼ ਗੋਲਡ ਹੈ ਜਿਵੇਂ ਦਾ ਮੈਂ ਇਹ ਫ਼ੋਨ ਦੇਖਿਆ ਸੀ ਉਵੇਂ ਦਾ ਹੀ ਇਹ ਮੈਂ ਪ੍ਰਾਪਤ ਕੀਤਾ ਹੈ ਇਸਦੀ ਡਿਲਵਰੀ ਦੋ ਹਫ਼ਤੇ ਵਿੱਚ ਹੋਣੀ ਸੀ ਪਰ ਮੈਨੂੰ ਇਹ ਫ਼ੋਨ ਇੱਕ ਹਫ਼ਤੇ ਵਿੱਚ ਮਿਲ ਗਿਆ ਹੈ ਜੋ ਕਿ ਜਿਸ ਦੀ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਇਸਦੀ ਪੈਕਿੰਗ ਬਹੁਤ ਹੀ ਵਧੀਆ ਢੰਗ ਨਾਲ਼ ਕੀਤੀ ਹੋਈ ਹੈ ਇਸਨੂੰ ਇੱਕ ਗੋਰੀਲਾ ਗਾਰਡ ਲੱਗਿਆ ਹੋਇਆ ਹੈ ਜੋ ਕਿ ਇਸਨੂੰ ਪੂਰੀ ਤਰ੍ਹਾਂ ਪ੍ਰੋਟੈਕਸ਼ਨ ਦਿੰਦਾ ਹੈ ਫ਼ੋਨ ਦੀ ਕੈਮਰਾ ਕੁਐਲਿਟੀ ਬਹੁਤ ਹੀ ਵਧੀਆ ਹੈ ਇਸ ਵਿੱਚ ਸਾਰੀਆਂ ਹੀ ਫੋਟੋਆਂ ਬੜੀ ਹੀ ਸਾਫ਼ ਆਉਂਦੀਆਂ ਹਨ ਇਸ ਦਾ ਪ੍ਰੋਸੈਸਰ ਬਹੁਤ ਹੀ ਜ਼ਿਆਦਾ ਵਧੀਆ ਹੈ ਇਸ ਦੇ ਸ ਫ਼ੀਚਰਜ਼ ਸਮੂਦ ਹਨ ਇਸ ਦੀ ਨੈੱਟਵਰਕ ਕੁਐਲਿਟੀ ਵੀ ਬਹੁਤ ਹੀ ਜ਼ਿਆਦਾ ਵਧੀਆ ਹੈ ਤੁਸੀਂ ਮੈਨੂੰ ਇਹ ਫ਼ੋਨ ਵੀਹ ਪ੍ਰਸੈਂਟ ਡਿਸਕਾਊਂਟ 'ਤੇ ਦਿੱਤਾ ਜਿਸ ਤੋਂ ਬਾਅਦ ਮੇਰੇ ਸਾਰੇ ਹੀ ਦੋਸਤ ਬੜੇ ਹੀ ਹੈਰਾਨ ਹੋ ਗਏ ਮੈਂ ਆਪਣੇ ਸਾਰੇ ਹੀ ਫ਼ਰੈਂਡਸ ਨੂੰ ਰੈਕਮੈਂਡ ਕਰਦੀ ਹਾਂ ਕਿ ਜੇ ਤੁਸੀਂ ਵੋਚ ਲੈੱਪਟਾਪ ਮੋਬਾਈਲ ਫ਼ੋਨ ਫ਼ੋਨ ਕਵਰ ਅਤੇ ਹੋਰ ਵੀ ਕੋਈ ਚੀਜ਼ ਖਰੀਦਣੀ ਹੋਵੇ ਤਾਂ ਉਹ ਤੁਹਾਡੀ ਹੀ